ਅੱਜ ਕੱਲ੍ਹ ਜੋ ਸਭ ਤੋਂ ਜ਼ਿਆਦਾ ਸਮੱਸਿਆ ਤਕਨੀਕੀ ਸਮੱਸਿਆ ਦਾ ਲੋਕ ਸਾਹਮਣਾ ਕਰ ਰਹੇ ਹਨ ਉਹ ਹੈ ਸਾਈਬਰ ਕ੍ਰਾਈਮ ਸਾਈਬਰ ਕ੍ਰਾਈਮ ਮਤਲਬ ਆਪਣਾ ਡਾਟਾ ਹੈਕ ਹੋ ਜਾਂਦਾ ਆਪਣੇ ਅਕਾਊਂਟਸ ਹੈਕ ਹੋ ਜਾਂਦੇ ਆ ਵਾਇਰਸ ਵਗੈਰਾ ਇਹ ਸਾਈਬਰ ਕ੍ਰਾਈਮ ਦੇ ਅਲੱਗ ਅਲੱਗ ਟਾਈਪਸ ਹਨ ਅਤੇ ਇਸ ਤੋਂ ਬਚਣ ਲਈ ਮੈਂ ਲੋਕਾਂ ਨੂੰ ਸੁਜੈਸਟ ਕਰਦੀ ਹਾਂ ਕਿ ਅੱਛੇ ਐਂਡ ਰਿਲਾਈਬਲ ਸੋਫਟਵੇਅਰ ਯੂਜ ਕਰੋ ਕੋਈ ਵੀ ਤੁਹਾਨੂੰ ਲਿੰਕ ਆਉਂਦਾ ਤੁਹਾਡੇ ਫੋਨ 'ਤੇ ਜਿਹਦੇ ਬਾਰੇ ਤੁਹਾਨੂੰ ਜਾਣਕਾਰੀ ਨਹੀਂ ਆ ਉਹਨੂੰ ਤੁਸੀਂ ਲਿੰਕ ਨੂੰ ਪ੍ਰੈਸ ਨਾ ਕਰੋ ਕਿਉਂਕਿ ਉਹਦੇ ਦੁਆਰਾ ਤੁਹਾਡੇ ਅਕਾਊਂਟ ਵਿੱਚੋਂ ਕਿਸੇ ਵੀ ਤਰ੍ਹਾਂ ਦਾ ਫਰੋਡ ਹੋਣ ਦਾ ਪੈਸਾ ਵਗੈਰਾ ਨਿਕਲਣ ਦਾ ਇਹ ਖਤਰਾ ਬਣਿਆ ਰਹਿੰਦਾ